ਹੈਲੋ ਹਾਂਜੀ ਅਸੀਂ ਨਾ ਤੁਹਾਡਾ ਪ੍ਰੋਡਕਟ ਖਰੀਦਿਆ ਸੀਗਾ ਫੇਸ ਵੋਸ਼ ਦਾ ਅਤੇ ਇੱਕ ਬੋਡੀ ਵੋਸ਼ ਸੀਗਾ ਅਤੇ ਫੇਸ ਵੋਸ਼ ਸੀਗਾ ਬਟ ਉਹਨਾਂ ਦੋਨਾਂ ਦੇ ਵਿੱਚੋਂ ਫੇਸ ਵੋਸ਼ ਦਾ ਬਿਲਕੁਲ ਵੀ ਵਧੀਆ ਰਿਸਪੋਂਸ ਨਹੀਂ ਸੀਗਾ ਜਮਾਂ ਵੀ ਨੈਗਟਿਵ ਸੀਗਾ ਉਹਦਾ ਰਿਸਪੋਂਸ ਕਿਉਂਕਿ ਉਹਦਾ ਜਦੋਂ ਅਸੀਂ ਅ ਯੂਜ਼ ਕੀਤਾ ਉਹਦੀ ਐਡ 'ਚ ਤਾਂ ਬਹੁਤ ਕੁਛ ਦਿਖਾ ਰਹੇ ਸੀ ਫੇਸ ਸ਼ਾਈਨ ਕਰੂਗਾ ਪਿੰਪਲਸ ਖ਼ਤਮ ਹੋਣਗੇ ਉਹਦੇ ਵਿੱਚ ਬਲੈਕਨਸ ਅਤੇ ਡਰਾਈਨੈਸ ਹੈ ਜਿਹੜੀ ਹੈਗੀ ਆ ਉਹ ਦੂਰ ਹੋਊਗੀ ਪਰ ਉਹਦੇ ਵਿੱਚ ਤਾਂ ਕੁਛ ਵੀ ਨਹੀਂ ਹੋਇਆ ਉਲਟਾ ਕੀ ਉਹਦਾ ਹ ਉਹ ਹੋ ਗਿਆ ਸਾਡੇ 'ਤੇ ਮੇਰੇ ਫੇਸ ਦੇ ਉੱਪਰ ਪਿੰਪਲਸ ਹੋ ਗਏ ਉਹਦੇ ਨਾਲ ਫਿੰਨਸੀਆਂ ਹੋ ਗਈਆਂ ਅਤੇ ਉਹਦੇ 'ਚ ਕੋਈ ਉਹਦਾ ਇੰਨਾ ਕੋਈ ਖ਼ਾਸ ਜ਼ਿਆਦਾ ਵਧੀਆ ਰਿਸਪੋਂਸ ਨਹੀਂ ਆਇਆ ਹੈਗਾ ਤੁਹਾਡਾ ਅਤੇ ਤੁਸੀਂ ਐਡ ਦੇ ਵਿੱਚ ਤਾਂ ਇੰਨਾ ਕੁਛ ਦਿਖਾ ਰੱਖਿਆ ਸੀਗਾ ਵੀ ਇਹਨਾਂ ਸਾਡਾ ਪ੍ਰੋਡਕਟ ਵਧੀਆ ਹੈਗਾ ਇਹ ਇਹਦੇ ਵਿੱਚ ਉਹਦੇ ਕੋਈ ਵੀ ਜ਼ਿਆਦਾ ਵਧੀਆ ਅਸਰ ਨਹੀਂ ਹੈਗਾ ਸੀਗਾ ਅਤੇ ਨਾ ਹੀ ਉਹਦੇ ਨਾਲ ਕੋਈ ਫੇਸ ਸ਼ਾਈਨ ਹੋ ਰਿਹਾ ਸੀਗਾ ਨਾ ਹੀ ਉਹਦੇ ਵਿੱਚ ਕੁਛ ਸ਼ਾਈਨਿੰਗ ਵਾਲਾ ਹੈਗਾ ਸੀਗਾ ਅਤੇ ਨਾ ਹੀ ਕੋਈ ਉਹਦੇ ਨਾਲ ਗਲੋਅ ਆ ਰਿਹਾ ਸੀ ਫੇਸ ਦੇ ਉੱਪਰ ਉਲਟਾ ਕੀ ਅਸੀਂ ਉਹਦੀ ਮਤਲਬ ਇੰਨੇ ਪੇਅ ਕਰਨ ਦੇ ਬਾਵਜੂਦ ਵੀ ਸਾਨੂੰ ਕੋਈ ਜ਼ਿਆਦਾ ਵਧੀਆ ਨਹੀਂ ਮਿਲਿਆ ਹੈਗਾ ਉਹਦਾ ਕੋਈ ਵਧੀਆ ਅਸਰ ਨਹੀਂ ਹੋਇਆ ਉਹਦੇ ਉੱਪਰ ਸਾਨੂੰ ਤਾਂ ਇਹਦੇ ਵਿੱਚ ਐਵੇਂ ਸੀਗਾ ਕਿ ਤੁਹਾਡਾ ਜਿਹੜਾ ਹੈਗਾ ਵਧੀਆ ਹੋਊਗਾ ਪ੍ਰੋਡਕਟ ਅਸੀਂ ਤਾਂ ਹੀ ਤੁਹਾਡੀ ਐਡ ਦੇਖ ਕੇ ਫਲਿੱਪਕਾਰਟ ਤੋਂ ਔਡਰ ਕੀਤਾ ਸੀਗਾ ਬਟ ਤੁਹਾਡਾ ਕੋਈ ਜ਼ਿਆਦਾ ਵਧੀਆ ਰਿਸਪੋਂਸ ਹੈ ਨਹੀਂ ਉਹਦੇ ਵਿੱਚ ਅਤੇ ਉਹਦਾ ਜਿਹੜਾ ਹੈਗੀ ਉਹ ਖੁਸ਼ਬੂ ਵੀ ਵਧੀਆ ਨਹੀਂ ਹੈਗੀ ਉਹਦੇ ਵਿੱਚ ਬਹੁਤ ਜ਼ਿਆਦਾ ਮਤਲਬ ਗੰਦੀ ਸਮੈੱਲ ਆਉਂਦੀ ਹੈਗੀ ਐਗੀ ਅਤੇ ਉਹਦੇ ਉਹ ਓਨਾ ਹੈ ਨਹੀਂ ਗਾ ਜਿੰਨਾ ਕਿ ਤੁਸੀਂ ਉਹ ਦਿਖਾ ਰੱਖਿਆ ਸੀਗਾ ਅਤੇ ਉਹਦੇ ਨਾਲ ਦੂਸਰਾ ਵੋਸ਼ ਆਇਆ ਸੀਗਾ ਬੋਡੀ ਵੋਸ਼ ਉਹ ਵੀ ਨਹੀਂ ਵਧੀਆ ਹੈਗਾ ਦੋਨੋਂ ਦੋਨੋਂ ਪ੍ਰੋਡਕਟ ਤੁਹਾਡੇ ਬਿਲਕੁਲ ਵਧੀਆ ਨਹੀਂ ਆਏ ਸਾਡੇ ਕੋਲ ਅਤੇ ਸਾਨੂੰ ਓਨਾ ਬਿਲਕੁਲ ਵੀ ਅੱਛਾ ਨਹੀਂ ਲੱਗਿਆ ਜਿਹੜਾ ਤੁਸੀਂ ਭੇਜਿਆ ਸਾਨੂੰ ਤਾਂ ਇਹਦਾ ਸਾਡੀ ਇਹੀ ਰਿਕੁਐਸਟ ਹੈਗੀ ਹੈ ਤੁਹਾਨੂੰ ਬੇਨਤੀ ਕਰਦੇ ਹਾਂ ਕਿ ਸਾਨੂੰ ਰਿਫੰਡ ਕੀਤਾ ਜਾਵੇ ਅਤੇ ਜਿਹੜਾ ਹੈਗਾ ਤੁਹਾਨੂੰ ਤੁਹਾਡਾ ਜਿਹੜਾ ਪ੍ਰੋਡਕਟ ਅਸੀਂ ਵਾਪਸ ਭੇਜ ਰਹੇ ਹਾਂ ਅਤੇ ਸਾਨੂੰ ਇਹਦੇ ਜਿਹੜੇ ਹੈਗੇ ਆ ਪੈਸੇ ਸਾਡੇ ਵਾਪਸ ਸਾਨੂੰ ਸਾਡੇ ਕੀਤੇ ਜਾਣ ਜਾਂ ਸਾਨੂੰ ਉਸ ਤੋਂ ਜ਼ਿਆਦਾ ਉਸ ਕੰਪਨੀ ਦਾ ਥੋੜ੍ਹਾ ਜਿਹਾ ਹੋਰ ਇਸ ਤੋਂ ਵਧੀਆ ਵਾਲਾ ਭੇਜੋ ਤਾਂ ਇਹ ਸਾਡੀ ਵੀ ਸੈਟੀਸਫੈਕਸ਼ਨ ਹੋ ਜੇ ਕਿ ਹਾਂ ਅਸੀਂ ਕੁਛ ਮੰਗਵਾਇਆ ਸੀ ਅਤੇ ਇਹਦਾ ਰਿਜ਼ਲਟ ਵਧੀਆ ਮਿਲਿਆ ਸਾਨੂੰ ਅਸੀਂ ਅਗਾਂਹ ਵੀ ਕਿਸੇ ਨੂੰ ਦੱਸ ਸਕੀਏ ਬਸ